ਹੈਲੋ ਹਾਂਜੀ ਬੇਅੰਤ ਜੀ ਗੱਲ ਕਰ ਰਹੇ ਹੈ ਮੈਂ ਰੀਚਾ ਗੱਲ ਕਰ ਰਹੀ ਹਾਂ ਮੈਨੂੰ ਮੇਰੀ ਇੱਕ ਫਰੈਂਡ ਨੇ ਅਮਨ ਨੇ ਤੁਹਾਡਾ ਨੰਬ ਦਿੱਤਾ ਸੀਗਾ ਮੈਂ ਪਟਿਆਲਾ ਦੇ ਵਿੱਚ ਮੈਂ ਪਟਿਆਲਾ ਵਿੱਚ ਪਹਿਲੀ ਵਾਰ ਆਈ ਹਾਂ ਅਤੇ ਮੈਨੂੰ ਥੋੜ੍ਹੀ ਜਿਹੀ ਤੁਹਾਡੀ ਹੈਲਪ ਚਾਹੀਦੀ ਸੀਗੀ ਮੈਨੂੰ ਕੈਂ ਤੁਸੀਂ ਗਾਈਡ ਕਰ ਸਕਦੇ ਹੋ ਕਿ ਪਟਿਆਲਾ ਦੇ ਵਿੱਚ ਕਿਹੜੀ ਕਿਹੜੀ ਮਾਰਕੀਟ ਕੱਪੜੇ ਦੇ ਲਈ ਅੱਛੀ ਹੈ ਅੱਛਾ ਜੀ ਅਤੇ ਜੇ ਆਪਾਂ ਨੇ ਰਾਸ਼ਨ ਲੈਣਾ ਹੋਵੇ ਫਿਰ ਅੱਛਾ ਜੀ ਤੁਸੀਂ ਮੈਨੂੰ ਨੰਬਰ ਵੀ ਭੇਜ ਦੇਣਾ ਅਤੇ ਮੈਨੂੰ ਤੁਸੀਂ ਥੋੜ੍ਹੀ ਜਿਹੀ ਉਹਨਾਂ ਦੀ ਲੋਕੇਸ਼ਨ ਵੀ ਦੱਸ ਅੱਛਾ ਜੀ ਠੀਕ ਹੈ ਅਤੇ ਮੈਡਮ ਮੈਨੂੰ ਤੁਸੀਂ ਇਹ ਦੱਸੋਂਗੇ ਕਿ ਬਿਊਟੀ ਸਰਵਿਸਿਜ਼ ਲੈਣੀਆਂ ਹੋਣ ਤਾਂ ਕਿੱਥੇ ਤੋਂ ਆਪਾਂ ਨੂੰ ਅੱਛੇ ਮਿਲ ਜਾਣਗੇ ਅੱਛਾ ਜੀ ਠੀਕ ਹੈ ਮੈਡਮ ਥੈਂਕ ਯੂ ਕੱਢਿਆ ਮੇਰੇ ਲਈ ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹਵਾਂਗੀ ਮੈਡਮ ਜੇ ਮਤਲਬ ਜਿੰਮ ਜੁਆਇਨ ਕਰਨਾ ਹੋਵੇ ਤਾਂ ਜਿੰਮ ਤੁਸੀਂ ਕਿਹੜਾ ਸੁਜੈਸਟ ਕਰੋਂਗੇ ਅੱਛਾ ਜੀ ਠੀਕ ਹੈ ਥੈਂਕ ਯੂ ਮੈਡਮ ਹਾਂਜੀ ਓਕੇ ਜੀ ਬਾਏ